ਭਾਅ ਜੀ ਹੋਰ ਕਿੱਦਾਂ ਹਾਲ ਚਾਲ ਵਧੀਆ ਜੀ ਮੈਂ ਨਾ ਜਿਹਾ ਮਾੜਾ ਜਾ ਕੰਮ ਸੀ ਜੀ ਮੈਂ ਪਟਿਆਲੇ ਨਵਾਂ ਸ਼ਿਫਟ ਹੋਇਆ ਸੀ ਮੈਂ ਜੀ ਚੰਡੀਗੜੋਂ ਸੈਕਟਰ ਅੱਠ ਮੈਂ ਜੀ ਮਾਰਕੀਟ ਐਡਵਾਈਜ਼ਰ ਸੀਗਾ ਜੋਬ ਕਰਕੇ ਸ਼ਿਫਟ ਹੋਇਆ ਉਰੇ ਜੇ ਕੇ ਸੀਮਿੰਟ 'ਚ ਜੀ ਹਾਂਜੀ ਹਾਂਜੀ ਮਾਰਕੀਟ ਐਡਵਾਈਜ਼ਰ ਆ ਜੀ ਹਾਏ ਉਹ ਮਾੜਾ ਜਿਹਾ ਨਾ ਜੀ ਸਮਾਨ ਵਗੈਰਾ ਦਾ ਪਤਾ ਨਹੀਂ ਸੀ ਜੀ ਸਮਾਨ ਲੈਣਾ ਸੀ ਥੋੜ੍ਹਾ ਜਿਵੇਂ ਕਰਿਆਨੇ ਦਾ ਜ਼ਿਆਦਾ ਹਾਂਜੀ ਹਾਂਜੀ ਠੀਕ ਹੈ ਜੀ ਅਤੇ ਹਾਂਜੀ ਹਾਂਜੀ

ਠੀਕ ਹੈ ਜੀ ਅੱਛਾ ਜੀ ਬੱਸ ਜੀ ਅਤੇ ਮਾੜਾ ਜਿਹਾ ਹੋਰ ਸੀਗਾ ਜੀ ਇੱਕ ਕੰਮ ਡੈ ਡਾਇਰੀ ਕਿਹੜੀ ਵਧੀਆ ਜੀ ਉਰੇ ਕਟਾਰੀਆ ਵੈਕਰੀ ਦਾ ਇੱਕ ਜਿਵੇਂ ਤੁਸੀਂ ਦੱਸੀ ਹੈ ਇੱਕ ਮੈਨੂੰ ਕਿਸੇ ਹੋਰ ਨੇ ਦੱਸੀ ਸੀ ਜੀਤ ਡਾਇਰੀ ਉਹ ਮੈਨੂੰ ਪਤਾ ਨਹੀਂ ਹੈ ਕਿੱਥੇ ਹੈ ਅਤੇ ਵਧੀਆ ਵੀ ਹੈ ਕੇ ਨਹੀਂ ਹਾਂਜੀ ਅਤੇ ਇੱਕ ਪੋਲੀ ਸਵੀਟ ਵੀ ਸੀਗਾ ਜੀ

ਵਧੀਆ ਜੀ ਬੱਸ ਧੰਨਵਾਦ ਜੀ ਬਹੁਤ ਮਦਦ ਕਰੀ ਹੈ ਜੀ ਜੇ ਕੁਝ ਹੋਰ ਗੱਲ ਹੋਈ ਤਾਂ ਫੋਨ ਕਰਾਂਗਾ ਜੀ ਠੀਕ ਹੈ ਜੀ